ਮੈਂ ਆਪਣੇ ਅਨੂਕ ਬਜਟ ਅਨੁਕੂਲ ਯਾਤਰਾ ਕੀਤੀ ਹੈ ਜਿਵੇਂ ਕਿ ਮੈਂ ਅੰਮ੍ਰਿਤਸਰ ਦੀ ਯਾਤਰਾ ਕੀਤੀ ਮੈਂ ਪਹਿਲਾਂ ਕਾਫੀ ਚਿਰ ਤੋਂ ਮੈਂ ਪਲੈਨਿੰਗ ਬਣਾਈ ਦੋ ਤਿੰਨ ਮਹੀਨੇ ਤੋਂ ਮੈਂ ਵੀ ਪਲੈਨਿੰਗ ਬਣਾਉਂਦਾ ਵੀ ਕਿੱਦਾਂ ਜਾਵਾਂ ਅਤੇ ਉਸ ਤੋਂ ਬਾਅਦ ਆਪਣੇ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕੀਤੇ ਮੈਂ ਬਜਟ ਬਣਾਇਆ ਅਤੇ ਉਸ ਤੋਂ ਬਾਅਦ ਆਪਣਾ ਤਿਆਰੀ ਕੀਤੀ ਫੇਰ ਤਿਆਰੀ ਕਰਕੇ ਆਪਾਂ ਇੱਥੋਂ ਆਪਣੇ ਪਿੰਡ ਤੋਂ ਗਏ ਅਤੇ ਆਪਣਾ ਅੰਬਰਸਰ ਗਏ ਅਤੇ ਉੱਥੇ ਜਾ ਕੇ ਮੱਥਾ ਮੁੱਥਾ ਟੇਕ ਕੇ ਪਰਿਕਰਮਾ ਕੀਤੀਆਂ ਅਤੇ ਉੱਥੇ ਜਾ ਕੇ ਸਾਨੂੰ ਬਹੁਤ ਹੀ ਆਨੰਦ ਆਇਆ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਬਹੁਤ ਅਸੀਂ ਉੱਥੇ ਘੁੰਮੇ ਕਾਫੀ ਗੁਰੂਆਂ ਦੇ ਦਰਸ਼ਨ ਕੀਤੇ ਯਾਨੀ ਕਿ ਕਾਫੀ ਪਰਿਕਰਮਾ ਕੀਤੀਆਂ ਯਾਨੀ ਕਿ ਸਾਨੂੰ ਬਹੁਤ ਵਧੀਆ ਲੱਗਿਆ ਆਲੇ ਦੁਆਲੇ ਦਾ ਅਸੀਂ ਬਹੁਤ ਜ਼ਿਆਦਾ ਵਧੀਆ ਆਨੰਦ ਕੀਤਾ ਉੱਥੇ ਬਹੁਤ ਜ਼ਿਆਦਾ ਵਧੀਆ